ਹਾਂਜੀ ਸਰ ਹਾਂਜੀ ਸਰ ਕੌਣ ਗੱਲ ਕਰ ਰਹੇ ਓ ਹਾਂਜੀ ਹਾਂਜੀ ਸਰ ਤੁਹਾਡੀ ਕੀ ਸਹਾਇਤਾ ਕਰ ਸਕਦੇ ਜੀ ਤੁਹਾਡੀ ਕੀ ਸਹਾਇਤਾ ਕਰ ਸਕਦੇ ਗੁਰ ਨਾਨਕ ਟੈਲੀਕੋਮ ਤੋਂ ਬੋਲਦੇ ਜੀ

ਸਰ ਆਪਣੇ ਕੋਲੇ ਫੋ ਫੋ ਫੋਰ ਜੀ ਦੇ ਪਲੈਨ ਤੁਸੀਂ ਜਾਣਨਾ ਚਾਉਂਦੇ ਓ ਕਿ ਫਾਈਵ ਜੀ ਦੇ ਜੀ ਹਾਂਜੀ ਸਰ ਆਪਣੇ ਫੋਰ ਜੀ ਵਿੱਚ ਪਲੈਨ ਹੈਗੇ ਜੀ ਇੱਕ ਤਾਂ ਮਹੀਨੇ ਆਲਾ ਪਲੈਨ ਵੀ ਐ ਜੀ ਉਹ ਜੇ ਤੁਸੀਂ ਪੰਦਰਾਂ ਦਿਨ ਆਲਾ ਕਰਾਓਂਗੇ ਤਾਂ ਇੱਕ ਸੌ ਉਣੀਜਾ ਰੁਪਏ ਆਲਾ ਜੀ ਠੀਕ ਐ ਜੀ ਤੇ ਜੇਕਰ ਤੁਸੀਂ ਮਹੀਨੇ ਆਲਾ ਕਰਵਾਉਣਾ ਚਾਉਨੇ ਓਂ ਉਹ ਆਪਾਂ ਨੂੰ ਪਹਿਲਾਂ ਤਾਂ ਪੈਂਦਾ ਸੀ ਦੋ ਸੌ ਉਨਤਾਲੀ ਦਾ ਜੀ ਡੇਢ ਜੀ ਬੀ ਹਰ ਰੋਜ ਡਾਟੇ ਆਲਾ ਜੀ ਤੇ ਹੁਣ ਇਹ ਤਿੰਨ ਸੌ ਆਲਾ ਕਰਤਾ ਜੀ ਉਨ੍ਹਾਂ ਨੇ ਕੰਪਨੀ ਆਲਿਆਂ ਨੇ ਹਾਂਜੀ ਹਾਂਜੀ ਫਾਈਵ ਜੀ ਸਰ ਬਸ ਆਪ ਨੂੰ ਸੌ ਕ ਰੁਪਏ ਵੱਧ ਪੈਂਦਾ ਜਿਵੇਂ ਚਾਰ ਸੌ ਰੁਪਏ ਆਲਾ ਪੈਂਦਾ ਜੀ ਪਲੈਨ ਤੇ ਉਹਦੇ 'ਚ ਵੀ ਤੁਸੀਂ ਅਨਲਿਮਟਡ ਚਲਾ ਸਕਦੇ ਓਂ ਫਾਈਵ ਜੀ ਜੇ ਤੁਹਾਡੇ ਕੋਲੇ ਹੈਂਡਸੈੱਟ ਤੁਹਾਡਾ ਆਪਣਾ ਫਾਈਵ ਜੀ ਐ ਤੇ ਪਲੈਨ ਲੈਨੇ ਓਂ ਤੇ ਅਨਲਿਮਟਡ ਚਲਾ ਸਕਦੇ ਓ ਕੋਈ ਉਹਦਾ ਇੱਦਾਂ ਹੈ ਨੀ ਖਤਮ ਹੋਣ ਆਲਾ ਕੋਈ ਚੱਕਰ ਨੀ ਹਾਂਜੀ ਹਾਂਜੀ ਸਰ ਉਹ ਚਲੋ ਮੰਨ ਕੇ ਚਲੋ ਜੇ ਤੁਸੀਂ ਮੰਨ ਕੇ ਚਲੋ ਛੇ ਮਹੀਨੇ ਆਲਾ ਕਰੋਨੇ ਆਂ ਜੀ ਉਹਦੇ ਚ ਥੋਨੂੰ ਮੰਨ ਕੇ ਚਲੋ ਪੰਦਰਾਂ ਕ ਦਿਨਾਂ ਦਾ ਲੈੱਸ ਹੋ ਸਕਦਾ ਜੀ ਤੇ ਜੇ ਉਹ ਸਾਲ ਆਲਾ ਕਰੋਨੇ ਆਂ ਜੀ ਉਹਦੇ ਚ ਥੋਨੂੰ ਮੰਨ ਕੇ ਚਲੋ ਸਾਲ ਆਲੇ ਚ ਮਹੀਨੇ ਕ ਦਾ ਲੈੱਸ ਮਿਲ ਸਕਦਾ ਜਿਵੇਂ ਕੀ ਮਹੀਨੇ ਦਾ ਤਿੰਨ ਸੌ ਰੁਪਈਆ ਲੈੱਸ ਹੋ ਸਕਦਾ

ਦੇਖੋ ਸਰ ਹੁਣ ਥੋਡੀ ਚਲਾਈ ਦੇ ਸਿਰ ਤੇ ਐ ਮੰਨ ਕੇ ਚਲੋ ਤੁਸੀਂ ਵੀ ਵਨ ਜੀ ਬੀ ਨਾਲ ਸਾਰ ਰਹੇ ਓ ਕੇ ਡੇਢ ਜੀ ਬੀ ਨਾਲ ਸਾਰ ਓ ਤੇ ਹਾਂਜੀ ਹਾਂਜੀ ਹਾਂਜੀ ਅੱਛਾ ਡੇਢ ਜੀ ਬੀ ਨਾਲ ਚਲੋ ਡੇਢ ਜੀ ਬੀ ਆਲਾ ਪਲੈਨ ਵੀ ਹੈਗਾ ਜੀ ਆਪਣੇ ਕੋਲੇ ਆਪਣੇ ਕੋਲੇ ਸਿ ਸਿਮ ਦੱਸੋ ਕਿਹੜੀ ਕੋਂਪਣੀ ਦਾ ਜੀ ਹਾਂਜੀ ਹਾਂਜੀ ਥੋਡੇ ਕੋਲ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂ ਸਰ ਜੀਓ ਆਲਾ ਪਲੈਨ ਲਓ ਤੁਸੀਂ ਜੀਓ ਆਲੇ ਪਲੈਨ ਚ ਵਧੀਆ ਆ ਰਹੇ ਐ ਤੇ ਉਨ੍ਹਾਂ ਚ ਕੋਈ ਨਾ ਨੈਟਵਰਕ ਦਿੱਕਤ ਵੀ ਨੀ ਰਹੀ ਉਹ ਜਿੱਥੇ ਤੁਸੀਂ ਜਿੱਥੇ ਵੀ ਤੁਸੀਂ ਜਾਓਗੇ ਜੇ ਕਦੇ ਉਨ੍ਹਾਂ ਦੀ ਨੈਟਵਰਕ ਦੀ ਪ੍ਰੋਬਲਮ ਵੀ ਨੀ ਆਊਗੀ ਤੇ ਥੋਨੂੰ ਕਿਤੇ ਵੀ ਕੁਛ ਪ੍ਰੇਸ਼ਾਨੀ ਨਹੀਂ ਆਊਗੀ ਤੇ ਡੇਢ ਜੀ ਬੀ ਤੁਸੀਂ ਡਾਟਾ ਲੈਣਾ ਪਸੰਦ ਕਰੋਂਗੇ ਹਾਂਜੀ ਪਹਿਲਾਂ ਪਹਿਲਾਂ ਦੋ ਸੌ ਉਨਤਾਲੀ ਦਾ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਸਰ ਕੋਈ ਦਿੱਕ ਹਾਂਜੀ ਹੁਣ ਵੇਖੋ ਤੁਸੀਂ ਮੰਨ ਕੇ ਚੱਲੋ ਤਿੰਨ ਸੌ ਰੁਪਏ ਦਾ ਪੈਂਦਾ ਤਾਂ ਆਪਣਾ ਤੁਸੀਂ ਡਵੈਡ ਕਰਲੋ ਬਾਰਾਂ ਨਾਲ ਠੀਕ ਐ ਜੀ ਹਾਂਜੀ ਛੱਤੀ ਤੇ ਉਹਦੇ ਚੋਂ ਆਪਣਾ ਤਿੰਨ

ਹਾਂਜੀ ਹਾਂਜੀ ਹਾਂਜੀ ਹਾਂਜੀ ਨਈਂ ਨਈਂ ਸਰ ਉਹ ਆਪਣੇ ਹੈਗਾ ਤੇ ਇੱਕ ਮਹੀਨੇ ਦਾ ਲੈੱਸ ਉਹ ਕਰਵਾ ਲੋ ਤੁਸੀਂ ਤੇ ਬਾਕੀ ਹਾਂਜੀ ਹਾਂਜੀ ਹਾਂਜੀ ਤੇ ਹਾਂਜੀ ਹਾਂਜੀ ਸਰ ਓਕੇ ਜੀ ਹੋਰ ਕੋਈ ਸਹਾਇਤਾ ਕਰ ਸਕਦਾ ਥੋਡੀ ਜੀ ਠੀ ਠੀਕ ਐ ਠੀਕ ਐ ਓਕੇ ਸਰ ਓਕੇ ਜੀ ਓਕੇ